ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਸੌ ਸੱਤਰ ਰੁਪਏ ਆ ਜੀ ਹਾਂਜੀ ਲਓ ਪਰ ਇਹ ਬੱਸ ਕਿਧਰੇ ਰਸਤੇ 'ਚ ਰੁਕੇਗੀ ਨਹੀਂ ਪਿੰਡ ਪੁੰਡ 'ਚ ਤੁਸੀਂ ਸਿੱਧਾ ਬਠਿੰਡੇ ਜਾਣਾ ਨਾ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਭੈਣ ਜੀ ਤੁਸੀਂ ਇੱਕ ਵਾਰੀ ਇੱਥੇ ਰੁਕੋ ਮੈਂ ਅੱਗੇ ਜਾ ਕੇ ਸੀਟ ਦੇਖਦਾ ਚੈੱਕ ਕਰਦਾ ਤੁਹਾਨੂੰ ਹੁਣੇ ਅੱਗੇ ਐਡਜਸਟ ਕਰਵਾ ਦਾਂਗੇ ਠੀਕ ਹੈ ਜੀ ਠੀਕ ਆਜੋ ਭੈਣ ਜੀ ਆਜੋ ਅੱਗੇ ਆ ਜਾਓ ਤੁਸੀਂ ਡਰਾਈਵਰ ਦੇ ਨਾਲ ਵਾਲੀ ਇੱਥੇ ਪਿਛਲੀ ਸੀਟ 'ਤੇ ਬੈਠ ਜਾਓ ਚੰਗਾ ਜੀ ਚੰਗਾ ਦੋ ਘੰਟਿਆਂ ਦਾ ਸਫਰ ਤਾਂ ਹੈਗਾ ਹੀ ਏ ਹਾਂਜੀ ਹਾਂਜੀ ਪਹੁੰਚੇਗੀ ਇਹ ਜਿਹੜਾ ਹਨੁਮਾਨ ਚੌਂਕ 'ਤੇ ਜਾਏਗੀ ਜੀ ਹਾਂਜੀ ਇਹ ਰੋਡਵੇਜ ਬੱਸ ਨਹੀਂ ਪ੍ਰਾਈਵੇਟ ਬੱਸਾਂ ਨੇ ਜਲਦੀ ਪਹੁੰਚਾ ਦੇਗੀ ਤੁਹਾਨੂੰ ਉੱਥੇ ਓਥੋਂ ਵੀ ਉਥੋਂ ਦੀ ਲੋਕਲ ਬੱਸਾਂ ਚੱਲਦੀਆਂ ਨੇ ਦੁਬਾਰੇ ਤੁਹਾਨੂੰ ਉੱਥੇ ਮਿਲ ਜਾਏਗੀ ਬਸ ਜਦ ਤੱਕ ਹਾਂਜੀ ਵਾਪਸੀ ਸੱਤ ਵਜੇ ਦੀ ਟਾਈਮਿੰਗ ਹੈ ਜੀ ਇੱਥੋਂ ਦੀ ਫਰੀਦਕੋਟ ਵਾਪਸੀ ਜਾਣ ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਤਾਂ ਹੈ ਪਰ ਭੈਣ ਜੀ ਕਿਸੇ ਨੂੰ ਮਨ੍ਹਾ ਨਹੀਂ ਕਰ ਸਕਦੇ ਨਾ ਅਸੀਂ ਪ੍ਰੇਸ਼ਾਨ ਕਰਦੇ ਨੇ ਹਾਂਜੀ ਠੀਕ ਹੈ ਜੀ ਕਰਦਾ ਹਾਂਜੀ